ਹਾਂਜੀ ਜੇ ਲਿਖਣ ਦੀ ਸ਼ੈੱਲੀ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਗਲਪ ਅਤੇ ਗੈਰ ਗਲਪ ਆ ਜੋ ਦੋ ਸ਼੍ਰੇਣੀਆਂ ਆਉਂਦੀਆਂ ਨੇ ਅਤੇ ਜੇ ਮੈਂ ਆਪਦੀ ਨਿੱਜੀ ਪਸੰਦ ਦੀ ਗੱਲ ਕਰਾਂ ਤਾਂ ਮੈਨੂੰ ਗਲਪ ਲਿਖਣਾ ਗਲਪ ਸੁਣਨਾ ਅਤੇ ਗਲਪ ਸਮਝਣਾ ਵਧੀਆ ਲੱਗਦਾ ਅਤੇ ਗਲਪ ਪੜ੍ਹਨਾ ਵੀ ਵਧੀਆ ਲੱਗਦਾ ਅਤੇ ਮੇਰੇ ਜੋ ਪਸੰਦੀਦਾ ਲੇਖਕ ਨੇ ਉਹ ਦਲੀਪ ਕੌਰ ਟਿਵਾਣਾ ਨੇ ਲੇਖਿਕਾ ਦਲੀਪ ਕੌਰ ਟਿਵਾਣਾ ਅਤੇ ਉਨ੍ਹਾਂ ਦੀਆਂ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਉਨ੍ਹਾਂ ਦੇ ਨੋਵਲ ਪੜ੍ਹੇ ਨੇ ਅਤੇ ਜਿਹਦੇ 'ਚੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਮੈਂ ਖੁਦ ਵੀ ਗਲਪ ਹੀ ਲਿਖਦਾ ਮੈਨੂੰ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਕ ਆ ਅਤੇ ਮੈਂ ਜੋ ਵੀ ਲਿਖਦਾ ਗਲਪ ਹੀ ਲਿਖਦਾ ਅਤੇ ਦਲੀਪ ਕੌਰ ਟਿਵਾਣਾ ਦੀ ਇੱਕ ਬੁੱਕ ਹੈਗੀ ਸੀ ਕਥਾ ਕਹੋ ਉਰਵਸ਼ੀ ਉਹ ਪੜ੍ਹੀ ਹੈ ਅਤੇ ਉਹਦੇ ਵਿੱਚ ਮੈਨੂੰ ਬਹੁਤ ਬਹੁਤ ਜ਼ਿਆਦਾ ਕੁਛ ਸਿੱਖਣ ਨੂੰ ਮਿਲਿਆ ਉਸ ਤੋਂ ਬਾਅਦ ਆਹ ਤੁਮਰੀ ਕਥਾ ਗਣੀ ਨਾ ਜਾਹਿ ਤੀਨ ਲੋਕ ਸੇ ਨਿਆਰੀ ਅਤੇ ਇੱਕ ਹੋਰ ਵੀ ਕਾਫ਼ੀ ਕਿਤਾਬਾਂ ਨੇ ਜੋ ਮੈਂ ਦਲੀਪ ਕੌਰ ਟਿਵਾਣਾ ਦੀਆਂ ਪੜ੍ਹੀਆਂ ਨੇ ਅਤੇ ਜੇ ਗੱਲ ਕੀਤੀ ਜਾਵੇ ਕਥਾ ਕਹੋ ਉਰਵਸ਼ੀ ਜਿਸਨੂੰ ਕਿ ਅਵਾਰਡਡ ਹੈ ਉਹ ਬੁੱਕ ਉਹਨੂੰ ਅਵਾਰਡ ਵੀ ਮਿਲਿਆ ਹੋਇਆ ਬੁੱਕ ਨੂੰ ਅਤੇ ਉਹਦੇ ਵਿੱਚੋਂ ਮੈਨੂੰ ਇੱਕ ਜ਼ਿੰਦਗੀ ਦਾ ਇੱਕ ਅਲੱਗ ਹੀ ਤਰ੍ਹਾਂ ਦਾ ਤਜਰਬਾ ਹਾਸਲ ਹੋਇਆ ਜਿਹਦੇ 'ਚ ਕੇ ਪਤਾ ਚਲਦਾ ਹੈ ਵੀ ਜਿਉਣ ਜਿਉਂਦੇ ਜੀਅ ਆਪਦੀਆਂ ਜੋ ਜ਼ਿੰਦਗੀ ਦੇ ਸੰਘਰਸ਼ ਨੂੰ ਜਿੰਦਗੀ 'ਚ ਜੋ ਪ੍ਰੋਬਲਮਸ ਨੇ ਉਨ੍ਹਾਂ ਨੂੰ ਫੇਸ ਕਰਨਾ ਜਾਂ ਉਨ੍ਹਾਂ ਨੂੰ ਸਮਝਣਾ ਉਨ੍ਹਾਂ ਦਾ ਮਕਾ ਉਨ੍ਹਾਂ ਦਾ ਮੁਕਾਬਲਾ ਕਰਨਾ ਬਹੁਤ ਜ਼ਰੂਰੀ ਆ ਕਿਸੇ ਵੀ ਤਰ੍ਹਾਂ ਬੰਦਾ ਆਪਦੀ ਜੋ ਜ਼ਿੰਮੇਵਾਰੀ ਹੈ ਉਹਦੇ ਤੋਂ ਭੱਜ ਨਹੀਂ ਸਕਦਾ ਅਤੇ ਜੋ ਉਹਦੇ 'ਚ ਜੇ ਮੇਨ ਗੱਲ ਕੀਤੀ ਜਾਵੇ ਉਹ ਸਾਰੇ ਦੇ ਨੋਵਲ ਦੀ ਉਹਦੇ ਵਿੱਚ ਸੁਸਾਇਡ ਜੋ ਬੰਦਾ ਖੁਸ਼ ਖ਼ੁਦਕੁਸ਼ੀ ਕਰਦਾ ਹੈ ਉਹਦੇ ਬਾਰੇ ਦੱਸਿਆ ਗਿਆ ਹੈ ਅਤੇ ਉਹਦੇ 'ਚ ਬਹੁਤ ਵਧੀਆ ਤਰੀਕੇ ਨਾਲ ਜੋ ਖ਼ੁਦਕੁਸ਼ੀ ਕੀਤੀ ਜਾਂਦੀ ਹੈ ਬੰਦੇ ਦੁਆਰਾ ਉਹਨੂੰ ਇੱਕ ਬਹੁਤ ਤਰੀਕੇ ਨਾਲ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਕਲਮਬੰਦ ਕਰਕੇ ਸਮਝਾਇਆ ਗਿਆ ਵੀ ਜੋ ਖੁਦਕੁਸ਼ੀ ਹੈ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੱਕ ਹੱਲ ਨਹੀਂ ਹੈ ਕਿਸੇ ਵੀ ਪ੍ਰੋਬਲਮ ਦਾ ਅਤੇ ਇਹਦੇ ਨਾਲੋਂ ਚੰਗਾ ਹੈ ਵੀ ਚੀਜ਼ਾਂ ਨੂੰ ਸਵੀਕਾਰਿਆ ਜਾਣਾ ਚਾਹੀਦਾ ਸਮਝਣਾ ਸਮਝਿਆ ਜਾਣਾ ਚਾਹੀਦਾ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਅਤੇ ਜੇ ਸੱਚ ਕਹਾਂ ਤਾਂ ਇਹ ਮੇਰਾ ਸਭ ਤੋਂ ਵਧੀਆ ਨੋਵਲ ਸੀ ਜ਼ਿੰਦਗੀ ਦਾ ਅਤੇ ਇਸ ਨੋਵਲ ਨੂੰ ਮੈਂ ਹੋਰ ਵੀ ਮੇਰੇ ਜੋ ਦੋਸਤ ਮਿੱਤਰ ਨੇ ਉਨ੍ਹਾਂ ਸਾਰਿਆਂ ਨੂੰ ਮੈਂ ਇਹ ਸੁਜੈਸਟ ਕੀਤਾ ਪੜ੍ਹਨ ਲਈ ਅਤੇ ਜਿੰਨਿਆਂ ਨੇ ਵੀ ਪੜ੍ਹਿਆ ਉਹਦੇ ਬਹੁਤ ਅੱਛੇ ਬਹੁਤ ਵਧੀਆ ਜ਼ਿਆਦਾ ਫੀਡਬੈਕ ਆਏ ਬਹੁਤ ਵਧੀਆ ਫੀਡਬੈਕ ਆਏ ਸਾਰਿਆਂ ਨੇ ਇਸ ਨੋਵਲ ਨੂੰ ਬਹੁਤ ਜ਼ਿਆਦਾ ਐਪ੍ਰਿਸ਼ੀਏਟ ਕੀਤਾ ਅਤੇ ਇਹ ਮੇਰਾ ਸਭ ਤੋਂ ਫੇਵਰਟ ਨੋਵਲ ਰਿਹਾ ਆਪਦੀ ਜ਼ਿੰਦਗੀ ਦਾ